ਬਠਿੰਡੇ ਦੇ ਵਿੱਚ ਚਾਰ ਸਿਨੇਮੇ ਆ ਉੜਾਂਗ ਸਿਨੇਮਾ ਬਹੁਤ ਮਸ਼ਹੂਰ ਹੈ ਅੱਜ ਵੀ ਚੱਲਦਾ ਅੱਜ ਸਿਨੇਮਿਆਂ ਦੀ ਜਗ੍ਹਾ ਵੱਡੇ ਵੱਡੇ ਮੌਲ ਦੇ ਵਿੱਚ ਥਿਏਟਰ ਬਣ ਗਏ ਨੇ ਬਠਿੰਡੇ ਮਿੱਤਲ ਮੌਲ ਹੈ ਮੈਨੂੰ ਯਾਦ ਹੈ ਵੀ ਸਿਨੇਮੇ ਦੇ ਵਿੱਚ ਫ਼ਿਲਮ ਦੇਖਣ ਦਾ ਇੱਕ ਅਲੱਗ ਹੀ ਚਾਅ ਹੁੰਦਾ ਸੀ ਛੋਟਾ ਹੁੰਦਾ ਸੀ ਜਦੋਂ ਮੈਂ ਮੇਰੀ ਡੈਡੀ ਜੀ ਦੇ ਨਾਲ ਗਿਆ ਸੀ ਫ਼ਿਲਮ ਦੇਖਣ ਮੇਰੇ ਡੈਡੀ ਜੀ ਦੇ ਨਾਲ ਜਦੋਂ ਮੈਂ ਗਿਆ ਸੀ ਉਦੋਂ ਲੋਹੜੀ ਦਾ ਦਿਨ ਸੀਗਾ ਲੋਹੜੀ ਦੇ ਦਿਨ ਅਮੀਰ ਖਾਨ ਦੀ ਫ਼ਿਲਮ ਸੀ ਉਹ ਜਦੋਂ ਮੈਂ ਪਹਿਲੀ ਵਾਰੀ ਫ਼ਿਲਮ ਦੇਖੀ ਸੀ ਰਾਜਾ ਹਿੰਦੁਸਤਾਨੀ ਫ਼ਿਲਮ ਦਾ ਨਾਮ ਸੀ ਉਸ ਤੋਂ ਬਾਅਦ ਬੜੇ ਮੀਆਂ ਛੋਟੇ ਮੀਆਂ ਮੈਂ ਸਕੂਲ 'ਚ ਪੜ੍ਹਦਾ ਸੀ ਸਕੂਲ ਵਾਲੇ ਸਕੂਲ ਵੱਲੋਂ ਲੈ ਕੇ ਗਏ ਸੀ ਉਦੋਂ ਮੈਂ ਦਸਵੀਂ 'ਚ ਪੜ੍ਹਦਾ ਸੀ ਤਾਂ ਉਸ ਤੋਂ ਬਾਅਦ ਫ਼ਿਲਮ ਦੇਖੀ ਸੀ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਫ਼ਿਲਮ ਦੇਖੀ ਸੀ ਮੈਂ ਪੀ ਕੇ ਪੀ ਕੇ ਫ਼ਿਲਮ ਦੇਖੀ ਸੀਗੀ ਲਾਸਟ ਮੈਂ ਸਿਨੇਮਾ ਦੇ ਵਿੱਚ ਥਿਏਟਰ ਦੇ ਵਿੱਚ ਫੈਮਿਲੀ ਦੇ ਨਾਲ ਸਿਨੇਮਾ ਜਾਣਾ ਬਹੁਤ ਵਧੀਆ ਲੱਗਦਾ ਕਿਉਂਕਿ ਕਈ ਫ਼ਿਲਮਾਂ ਐਸੀਆਂ ਹੁੰਦੀਆਂ ਜਿਹੜੀਆਂ ਫੈਮਲੀ ਨਾਲ ਦੇਖਣ 'ਤੇ ਹੀ ਆਨੰਦ ਆਉਂਦਾ ਅੱਜ ਵੀ ਬਠਿੰਡਾ ਦੇ ਵਿੱਚ ਥਿਏਟਰ ਚਾਹੇ ਪੁਰਾਣੇ ਹੋ ਗਏ ਪਰ ਅੱਜ ਵੀ ਇੱਕ ਦੋ ਫਿ ਸਿਨੇਮਾ ਐਸੇ ਨੇ ਜਿਵੇਂ ਉੜਾਂਗ ਸਿਨੇਮਾ ਹੈ ਮਿੱਤਲ ਮੌਲ ਦੇ ਵਿੱਚ ਥੀਏਟਰ ਹੈ ਜੋ ਕਿ ਲੋਕਾਂ ਦਾ ਮਨੋਰੰਜਨ ਕਰਦੇ ਨੇ ਲੋਕ ਸਮੇਂ ਸਮੇਂ 'ਤੇ ਉੱਥੇ ਜਾਂਦੇ ਨੇ ਮੈਨੂੰ ਵੀ ਜਦੋਂ ਮੌਕਾ ਮਿਲਦਾ ਪਰਿਵਾਰ ਦੇ ਨਾਲ ਜਦੋਂ ਕਿ ਬਹੁਤ ਹੀ ਅੱਛੀ ਮੂਵੀ ਦੇਖਦੇ ਹਾਂ ਉਹਦਾ ਟਰੇਲਰ ਦੇਖਦੇ ਹਾਂ ਵੀ ਇਹ ਫ਼ਿਲਮ ਪਰਿਵਾਰ ਨਾਲ ਦੇਖਣੀ ਜਾਂਦੀ ਚਾਹੀਦੀ ਹੈ ਤਾਂ ਮੈਂ ਜ਼ਰੂਰ ਪਰਿਵਾਰ ਦੇ ਨਾਲ ਸਿਨੇਮਾ ਜਾਂਦਾ